ਹਾਂਜੀ ਮੈਂ ਆਪਣੀ ਆਵਾਜ਼ ਵਿੱਚ ਇਹ ਸੰਦੇਸ਼ ਦੇਣਾ ਚਾਹਵਾਂਗਾ ਜਿਹੜੇ ਵੀ ਵਿਅਕਤੀ ਡੀਜੀਲੋਕਰ ਨੂੰ ਵਰਤਦੇ ਹਨ ਅਤੇ ਉਸਦਾ ਪਾਸਵਰਡ ਰੱਖਦੇ ਹਨ ਤਾਂ ਸਮੇਂ ਸਮੇਂ 'ਤੇ ਉਹਨਾਂ ਨੂੰ ਪਾਸਵਰਡ ਚੇਂਜ ਕਰਨਾ ਚਾਹੀਦਾ ਹੈ ਤਾਂ ਜੋ ਕਿ ਸਾਈਬਰ ਕ੍ਰਾਈਮ ਤੋਂ ਬਚਿਆ ਜਾ ਸਕੇ ਅਤੇ ਆਦਿ ਸੁਰੱਖਿਆ ਦੇਣ ਲਈ ਉਸ ਦੇ ਪਾਸਵਰਡ ਨੂੰ ਬਦਲਣਾ ਚਾਹੀਦਾ ਹੈ ਤਾਂ ਜੋ ਕਿ ਆਪਦੀ ਵੀ ਸੁਰੱਖਿਆ ਹੋ ਸਕੇ ਅਤੇ ਡੀਜੀਲਿਕਰ ਦੀ ਵੀ ਸੁਰੱਖਿਆ ਹੋ ਸਕੇ ਅਤੇ ਭਾਰੀ ਨੁਕਸਾਨ ਤੋਂ ਵੀ ਬਚਿਆ ਜਾ ਸਕੇ